ਹਾ ਜੀ ਨਹੀਂ ਕੁਝ ਸਮ ਸਮੇਂ ਤੋਂ ਅਸੀਂ ਆਪਣੀਆਂ ਤਸਵੀਰਾਂ ਜੋ ਸੋਸ਼ਲ ਮੀਡੀਆ ਅਕਾਊਂਟ ਹਨ ਉਹਨਾਂ 'ਤੇ ਪਹਿਲਾਂ ਤਾਂ ਅਸੀਂ ਆਪਣੀਆਂ ਤਸਵੀਰਾਂ ਖਿੱਚ ਕੇ ਅਪਲੋਡ ਕਰਦੇ ਸੀ ਪਰ ਅਸੀਂ ਹੁਣ ਕੁਝ ਸਮ ਸਮੇਂ ਤੋਂ ਜਿਸ ਤਰ੍ਹਾਂ ਔਨਲਾਈਨ ਡਾਟਿਆ ਚੋਰੀ ਹੋਣ ਦੀਆਂ ਜਾਂ ਤਸਵੀਰਾਂ ਦੀ ਗਲਤ ਦੁਰਵਰਤੋਂ ਹੋਣ ਕਰਕੇ ਅਸੀਂ ਜੋ ਸੋਸ਼ਲ ਮੀਡੀਆ ਅਕਾਊਂਟ ਹਨ ਜਿਸ ਤਰ੍ਹਾਂ ਫੇਸਬੁਕ ਜਾਂ ਇੰਸਟਾਗ੍ਰਾਮ ਜਾਂ ਸਨੈਪਚੈਟ ਵਗੈਰਾ 'ਤੇ ਅਸੀਂ ਆਪਣੀਆਂ ਫੋਟੋਆਂ ਬਹੁਤ ਘੱਟ ਅਪਲੋਡ ਕਰਨਾ ਜਾਂ ਪੋਸਟ ਕਰਨਾ ਅਸੀਂ ਇਸਨੂੰ ਨਹੀਂ ਕਰਦੇ ਪਹਿਲਾਂ ਕਰਦੇ ਸੀ ਪਰ ਹੁਣ ਨਹੀਂ ਕਰਦੇ ਕਿਉਂਕਿ ਇਹ ਸਾਡੀਆਂ ਵਾਇਰਲ ਹੋ ਕੇ ਇਹ ਨਹੀਂ ਪਤਾ ਕਿ ਤੁਹਾਡੀ ਤਸਵੀਰ ਕਿਸੇ ਦੀ ਗਰਦਨ ਕਿਸੇ ਦੀ ਹੋਰ ਨ ਅਤੇ ਗਰਦਨ ਤੁਹਾਡੀ ਹੋਵੇ ਅਤੇ ਸਰੀਰ ਕਿਸੇ ਦਾ ਹੋਰ ਹੋਵੇ ਕਿਸੇ ਦੇ ਨਾਲ ਐਡੀਟਿੰਗ ਕਰਕੇ ਤੁਹਾਡੀ ਫੋਟੋ ਦਾ ਕੀ ਬਣ ਜਾਵੇ ਅਤੇ ਇਸ ਕਰਕੇ ਅਸੀਂ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕਰਦੇ